ਮੈਂ ਰਜੇਸ਼ ਕੁਮਾਰ ਵਾਸੀ ਫਿਰੋਜ਼ਪੁਰ ਕਲਾਂ ਜ਼ਿਲ੍ਹਾ ਪਠਾਨਕੋਟ ਦਾ ਰਹਿਣ ਵਾਲਾ ਹਾਂ ਮੈਂ ਇਹ ਗੱਲ ਕਹਿੰਦਾ ਹਾਂ ਕਿ ਸਾਡੇ ਨਜ਼ਦੀਕੀ ਸ਼ਹਿਰ ਸੁਜਾਨਪੁਰ ਵਿਖੇ ਪੁਲ ਨੰਬਰ ਚਾਰ ਪੰਜ ਦੇ ਵਿਚਕਾਰ ਜੋ ਪਾਰਕ ਬਣਿਆ ਹੋਇਆ ਹੈ ਉੱਥੇ ਬੜਾ ਹੀ ਵਧੀਆ ਦ੍ਰਿਸ਼ ਦੇਖਣ ਵਾਲਾ ਹੁੰਦਾ ਹੈ ਜਿਸ ਤਰ੍ਹਾਂ ਉੱਥੇ ਬੱਚੇ ਖੇਡਦੇ ਹਨ ਬੱਚੇ ਬਿਆਮ ਕਰਦੇ ਹਨ ਬੱਚੇ ਸੈਰ ਕਰਦੇ ਹਨ ਹਰ ਕੋਈ ਬੱਚਾ ਬੁੱਢਾ ਜਵਾਨ ਉੱਥੇ ਘੁੰਮ ਫਿਰ ਸਕਦਾ ਹੈ ਅਤੇ ਮੈਂ ਇਹ ਗੱਲ ਵੀ ਕਹਿ ਸਕਦਾ ਹਾਂ ਕਿ ਪਠਾਨਕੋਟ ਵਿੱਚ ਜਿਹੜੇ ਥੀਏਟਰ ਹਨ ਉਹ ਲੋਕਾਂ ਦਾ ਮਨੋਰੰਜਨ ਕਰਨ ਵਿੱਚ ਭਰਪੂਰ ਸਹਿ ਸਹਿਯੋਗ ਦਿੰਦੇ ਹਨ ਸਾਡੇ ਸੁਜਾਨਪੁਰ ਵਿੱਚ ਸੁਜਾਨਪੁਰ ਤੋਂ ਇਲਾਵਾ ਨ ਰਣਜੀਤ ਸਾਗਰ ਡੈਮ ਵਿਖੇ ਇੱਕ ਮਿੰਨੀ ਗੋਆ ਨਾਂ ਦਾ ਇੱਕ ਪਾਰਕ ਹੈ ਜਾਂ ਇੱਕ ਸੈਰਗਾਹ ਹੈ ਜਿੱਥੇ ਲੋਕ ਬੜੇ ਹੀ ਵਧੀਆ ਤਰੀਕੇ ਨਾਲ ਜਾ ਕੇ ਆਪਣਾ ਮਨੋਰੰਜਨ ਕਰਦੇ ਹਨ ਧੰਨਵਾਦ